ਭੰਗੜਾ ਐਰਬਿਕਸ ਇੱਕ ਨਵਾਂ ਤਰੀਕੇ ਦੀ ਕਸਰਤ ਹੈ ਜਿਸ ਵਿੱਚ ਸਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਮਜ਼ਬੂਤ ਹੁੰਦਾ ਹੈ ਇਸ ਨਾਲ ਸਰੀਰ ਜ਼ਿਆਦਾ ਲਚੀਲਾ ਹੁੰਦਾ ਹੈ ਅਤੇ ਸਾਡੀ ਕੈਲਰੀ ਨੂੰ ਵੀ ਘਟਾਉਂਦਾ ਹੈ ਭੰਗੜਾ ਅਰੇਬਿਕਸ ਪੰਜਾਬ ਦੇ ਸੱਭਿਆਚਾਰ ਵਿਰਸੇ ਨੂੰ ਵੀ ਉਜਾਗਰ ਕਰਦਾ ਹੈ ਇਸ ਵਿੱਚ ਬੰਦਾ ਸਿਹਤ ਦੇ ਨਾਲ ਨਾਲ ਮਨੋਰੰਜਨ ਵੀ ਕਰ ਲੈਂਦਾ ਹੈ ਭੰਗੜਾ ਸਾਡੇ ਸੱਭਿਆਚਾਰ ਦਾ ਬਹੁਤ ਹੀ ਵੱਡਾ ਮਨ ਪ੍ਰਤੀਕ ਹੈ ਅਤੇ ਇਸ ਵਿੱਚ ਬੰਦਾ ਭੰਗੜੇ ਦੇ ਨਾਲ ਨਾਲ ਆਪਣੇ ਸੱਭਿਆਚਾਰ ਨਾਲ ਜੁੜਿਆ ਰਹਿੰਦਾ ਹੈ ਇਹ ਸਰੀਰ ਦਾ ਸਭ ਤੋਂ ਵਧੀਆ ਤਰੀਕਾ ਹੈ ਜਿਸ ਵਿੱਚ ਬੰਦਾ ਸਰੀਰ ਨੂੰ ਬਹਿਤਰ ਬਣਾ ਸਕਦਾ ਹੈ ਭੰਗੜਾ ਐਰਬਿਕਸ ਨਾਲ ਸਰੀਰ ਖੁੱਲਿਆ ਰਹਿੰਦਾ ਹੈ ਇਹ ਕਸਰਤ ਕਰਨ ਤੋਂ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ ਭੰਗੜਾ ਅਰੇਬਿਕਸ ਇੱਕ ਨਵੇਂ ਤਰੀਕੇ ਦਾ ਕਸਰਤ ਕਰਨ ਦਾ ਤਜ਼ਰਬਾ ਹੈ ਇਸ ਦੇ ਵਿੱਚ ਬੰਦੇ ਦਾ ਸਰੀਰ ਕਸਰਤ ਕਰਨ ਨਾਲੋਂ ਵੀ ਜ਼ਿਆਦਾ ਵਧੀਆ ਤਰੀਕੇ ਨਾਲ ਸਚੇਤ ਹੁੰਦਾ ਹੈ ਅਤੇ ਬੰਦਾ ਮਨੋਰੰਜਨ ਦੇ ਨਾਲ ਨਾਲ ਆਪਣੇ ਸਰੀਰ ਨੂੰ ਤੰਦਰੁਸਤ ਕਰ ਲੈਂਦਾ ਹੈ